ਹਾਂਜੀ ਮੈਂ ਇੱਥੇ ਨਾ ਲੋਕਲ ਨਿਊ ਆਇਆ ਸੀਗਾ ਅਤੇ ਮੈਂ ਇੱਥੇ ਪੁੱਛਣਾ ਸੀਗਾ ਕਿ ਨਾ ਮਤਲਬ ਇੱਥੇ ਨਾਲ ਕਿਹੜੇ ਕਿਹੜੇ ਸ਼ਹਿਰ ਲੱਗਦੇ ਆ ਮੈਂ ਰੇਲਵੇ ਸਟੇਸ਼ਨ ਕੋਈ ਬੋਲੀਆਂ ਨਾ ਤੁਸੀਂ ਹਾਂਜੀ ਅਤੇ ਉਹ ਪੁੱਛਣਾ ਸੀਗਾ ਨਾਲ ਕਿਹੜੇ ਕਿਹੜੇ ਸ਼ਹਿਰ ਲੱਗਦੇ ਅਤੇ ਮਤਲਬ ਉੱਥੇ ਕੀ ਕੀ ਕੁਛ ਘੁੰਮ ਸਕਦੇ ਹਾਂ ਆਪਾਂ ਹਾਂਜੀ ਹਾਂਜੀ ਕਿੱਥੇ ਕਿੱਥੇ ਜਾਂਦੇ ਕਿਹੜੇ ਸ਼ਹਿਰ ਨਾਲ ਲੱਗਦੇ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਮਤਲਬ ਹਾਂਜੀ ਹਾਂਜੀ ਕਿੱਥੇ ਗੁਰਦੁਆਰੇ ਹੈਗੇ ਆ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਇੱਥੇ ਫਿਰੋਜ਼ਪੁਰ ਹਾਂਜੀ ਹਾਂਜੀ ਹਾਂਜੀ ਕਿਹੜਾ ਬਾਰ ਕਿਹੜਾ ਕਿਹੜਾ ਬਾਰਡਰ ਆ ਓੱਥੇ ਠੀਕ ਹੈ ਜੀ

ਹਾਂਜੀ ਹਾਂਜੀ ਅਤੇ ਹੋਰ ਕੋਈ ਪਿੰਡ ਵਗੈਰਾ ਲੱਗਦੇ ਹੋਣ ਨਾਲ ਮੁ ਅੱਛਾ ਹਾਂਜੀ ਅੰਮ੍ਰਿਤਸਰ ਵਗੈਰਾ ਜਾਂਦੇ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਗ ਕੋਈ ਲੋਂਗ ਰੂਟ 'ਤੇ ਜਾਂਦੀ ਹੋਣ ਤਾਂ ਠੀਕ ਹੈ ਜੀ ਹਾਂਜੀ ਹੋਰ ਅਤੇ ਟਾਈਮਿੰਗ ਵਗੈਰਾ ਕੀ ਹੋਵੇਗੀ ਇਹਨਾਂ ਦੀ

ਠੀਕ ਹੈ ਜੀ ਹਾਂਜੀ ਧੰਨਵਾਦ